ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਪਹਿਲਾਂ ਅਸੀਂ ਕੋਈ ਵੀ ਕੰਮ ਕਰਦੇ ਸੀ ਤਾਂ ਅਸੀਂ ਕੀ ਕਰਦੇ ਸੀ ਅਗਰ ਕੋਈ ਪ੍ਰਸ਼ਨ ਉੱਤਰ ਅਸੀਂ ਯਾਦ ਵੀ ਕਰਨੇ ਹੁੰਦੇ ਸੀ ਜਾਂ ਫਿਰ ਅਸੀਂ ਕੋਈ ਵੀ ਪ੍ਰਸ਼ਨ ਉੱਤਰ ਲਿਖਣੇ ਹੁੰਦੇ ਸੀ ਤਾਂ ਉਸਨੂੰ ਅਸੀਂ ਕਾਗਜ਼ ਅਤੇ ਪੈਨ ਦੇ ਰਾਹੀਂ ਹੀ ਲਿਖਦੇ ਸੀ ਨਾਲ ਕੀ ਉਹ ਕਾਗਜ਼ 'ਤੇ ਪੈਨ ਦੇ ਰਾਹੀਂ ਲਿਖਣ ਨਾਲ ਸਾਨੂੰ ਯਾਦ ਵੀ ਜਲਦੀ ਹੋ ਜਾਂਦੇ ਸਨ ਅਤੇ ਅਸੀਂ ਉਸਨੂੰ ਲਿਖ ਕੇ ਪੜ੍ਹ ਸਕਦੇ ਹਾਂ ਤਾਂ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੀ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹੁਣ ਪੜ੍ਹਾਈ ਵੀ ਲੈਪਟੋਪ ਅਤੇ ਮੋਬਾਇਲ 'ਤੇ ਹੀ ਰਹਿ ਗਈ ਹੈ ਇਸ ਦੇ ਉੱਤੇ ਡਿਪੈਂਡ ਰਹਿਣ ਦੇ ਕਾਰਣ ਅਸੀਂ ਪੈਨ ਅਤੇ ਕਾਗਜ਼ ਦਾ ਘੱਟ ਯੂਜ ਕਰਦੇ ਹਾਂ ਪਰ ਸਾਨੂੰ ਜਦੋਂ ਬੇਸਿਕ ਤੋਂ ਕੁਛ ਵੀ ਪੜ੍ਹਨਾ ਅਤੇ ਲਿਖਣਾ ਚਾਹੀਦਾ ਹੈ ਜਾਂ ਲਿਖਣ ਲਿਖਣ ਦਾ ਵੱਲ ਆਉਂਦਾ ਹੈ ਤਾਂ ਅਸੀਂ ਕੋਈ ਵੀ ਕੰਮ ਕਰਨਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਪਹਿਲਾਂ ਅਸੀਂ ਕਾਗਜ਼ ਅਤੇ ਪੈਨ ਨਾਲ ਹੀ ਲਿਖੀਏ ਕਾਗਜ਼ ਅਤੇ ਪੈਨ ਨਾਲ ਲਿਖਣ ਦੇ ਨਾਲ ਉਹ ਸਾਡੀ ਮੈਮਰੀ ਦੇ ਵਿੱਚ ਫੀਡ ਹੋ ਜਾਂਦਾ ਹੈ ਅਗਰ ਅਸੀਂ ਕੁਝ ਵੀ ਯਾਦ ਕਰਨਾ ਹੁੰਦਾ ਹੈ ਤਾਂ ਸਾਨੂੰ ਉਹ ਯਾਦ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ ਮੋਬਾਇਲ ਅਤੇ ਲੈਪਟੋਪ ਵੀ ਬਹੁਤ ਅੱਛਾ ਸੋਰਸ ਹੈ ਪਰ ਸਾਨੂੰ ਅਗਰ ਪੜ੍ਹਾਈ ਦੇ ਮਾਮਲੇ ਦੇ ਵਿੱਚ ਹੋਵੇ ਤਾਂ ਸਾਨੂੰ ਹਮੇਸ਼ਾ ਹੀ ਕਾਪੀ ਅਤੇ ਪੈਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਲਿਖਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਯਾਦ ਰਹੇ